ਹਾਂਜੀ ਬਲਵਿੰਦਰ ਸਿੰਘ ਜੀ ਕੀ ਹਾਲ ਆ ਉਹ ਗੱਲ ਇਸ ਤਰ੍ਹਾਂ ਨਾ ਮੇਰੀ ਜਿਹੜੀ ਕਾਰ ਸੀਗੀ ਉਹਦੇ ਵਿੱਚ ਕੋਈ ਪ੍ਰੋਬਲਮ ਆ ਗਈ ਉਹ ਜਦੋਂ ਸਟਾਰਟ ਕਰਦੇ ਉਹਦੇ ਵਿੱਚ ਆਵਾਜ਼ ਜੀ ਆਉਂਦੀ ਆ ਅਤੇ ਹੁਣ ਮੈਂ ਇਹ ਚਾਹੁੰਦਾ ਤੂੰ ਪਹਿਲਾਂ ਕੈਬ ਚਲਾਉਂਦਾ ਹੁੰਦਾ ਹੁਣ ਵੀ ਮੈਨੂੰ ਪਤਾ ਤੇਰੇ ਕੋਲ ਹੈਗੀ ਆ ਸ਼ਾਇਦ ਵੀ ਜੇ ਮੈਨੂੰ ਇਹ ਦੱਸ ਵੀ ਮੈਂ ਚੰਡੀਗੜ੍ਹ ਜਾਣਾ ਯਾਰ ਚੰਡੀਗੜ੍ਹ ਜਦੋਂ ਮੈਂ ਜਾਣਾ ਵੀ ਜਿਹੜਾ ਭੁਗਤਾਨ ਆ ਉਹ ਮੇਰੇ ਕੋਲ ਜਿਹੜਾ ਕਾਰਡ ਦੀ ਆਪਸ਼ਨ ਨਹੀਂ ਹੈਗੀ ਕਾਰਡ ਮੇਰਾ ਹੋ ਗਿਆ ਐਕਸਪਾਇਰ ਉਹ ਕਾਰਡ ਮੈਂ ਅਪਲਾਈ ਕਰਿਆ ਵਾ ਪਰ ਹੁਣ ਇਸ ਟਾਈਮ ਮੇਰੇ ਕੋਲ ਕਾਰਡ ਹੈ ਨਹੀਂ ਵੀ ਜੇ ਹੁਣ ਵੀ ਮੈਂ ਤੈਨੂੰ ਪੈਸੇ ਨਕਦ ਏ ਦੇ ਦੇਵਾਂ ਜਾਂ ਮੈਂ ਤੈਨੂੰ ਪਹੁੰਚਣ ਤੋਂ ਬਾਅਦ ਵੀ ਤੂੰ ਘਰ ਆ ਜਾਵੇਂ ਵੀ ਤੈਨੂੰ ਬਾਅਦ ਵਿੱਚ ਕੈਸ਼ ਦੇ ਦੇਵਾ ਇੱਦਾਂ ਦੀ ਕੋਈ ਪੋਲਸੀ ਹੈ ਕੋਈ ਚੇਂਜ ਤਾਂ ਨਹੀਂ ਹੈ ਵੀ ਕੋਈ ਚੇਂਜ ਤਾਂ ਨਹੀਂ ਹੈ ਵੀ ਮੈਂ ਤੁਹਾਨੂੰ ਨਕਦ ਕਰ ਏ ਨਹੀਂ ਸਕਦਾ ਵੀ ਤੁਹਾਡੇ ਲਈ ਇਹ ਜ਼ਰੂਰੀ ਓ ਆ ਵੀ ਤੁਹਾਨੂੰ ਅਸੀਂ ਉਸੇ ਟਾਈਮ ਤੋਂ ਬਈ ਥੋ ਪੈਸੇ ਦੇਣੇ ਹੁੰਦੇ ਆ ਵੀ ਤੁਹਾਡੇ ਨੰਬਰ ਦੇ ਵਿੱਚ ਸ਼ੋਅ ਹੁੰਦਾ ਹੋਵੇ ਇੱਦਾਂ ਕੋਈ ਇੱਦਾਂ ਦਾ ਸੋਫਟਵੇਅਰ ਤਾਂ ਨਹੀਂ ਹੈ ਕਿਉਂਕਿ ਪਹਿਲਾਂ ਹੁੰਦਾ ਸੀਗਾ ਵੀ ਬੰਦਾ ਕੋਈ ਡਰਾਈਵਰ ਸਵਾਰੀ ਕੋਲ ਔਪਸ਼ਨ ਹੁੰਦੀ ਤੀ ਵੀ ਚਾਹੇ ਉਹ ਨਕਦ ਭੁਗਤਾਨ ਕਰ ਦੇਵੇ ਚਾਹੇ ਉਹ ਕਾਰਡ ਰਾਹੀਂ ਕਰ ਦੇਵੇ ਪਰ ਹੁਣ ਮੇਰੇ ਲਈ ਇਹ ਆ ਮੈਂ ਤੈਨੂੰ ਇਕੱਲਾ ਪੈਸੇ ਹੀ ਦੇ ਸਕਦਾ ਮੈਨੂੰ ਦੱਸੀਂ ਜ਼ਰੂਰ ਇਹ ਪਤਾ ਕਰਕੇ ਵੀ ਨਕਦ ਵਾਲੀ ਚੱਲਦੀ ਹੈ ਪ੍ਰਕਿਰਿਆ ਹਲੇ ਕ ਚੇਂਜ ਤਾਂ ਨਹੀਂ ਹੋਇਆ ਹਲੇ ਕਿਤੇ